ਮੇਰੀ ਮਨਪਸੰਦ ਫੋਟੋਗ੍ਰਾਫ ਪਿਛਲੇ ਸਾਲ ਦੀਆਂ ਛੁੱਟੀਆਂ ਦੀ ਹੈ ਜਿਸ ਵਿੱਚ ਮੈਂ ਕਸ਼ਮੀਰ ਘੁੰਮਣ ਗਈ ਸੀ ਅਤੇ ਆਪਣੀਆਂ ਯਾਦਾਂ ਨੂੰ ਸੰਜੋ ਕੇ ਰੱਖਣ ਲਈ ਮੈਂ ਬਹੁਤ ਫੋਟੋਆਂ ਖਿੱਚੀਆਂ ਅਤੇ ਫੋਟੋਗ੍ਰਾਫ ਬਣਾਏ ਅਸੀਂ ਸਾਰਾ ਪਰਿਵਾਰ ਜਦੋਂ ਘਰੋਂ ਨਿਕਲਣ ਲੱਗੇ ਮੈਂ ਸਭ ਤੋਂ ਮੈਂ ਸਭ ਦੀ ਬਾਏ ਬਾਏ ਟਾਟਾ ਟਾਟਾ ਵਾਲੀ ਬਲੋਗ ਵੀ ਬਣਾਈ ਅਤੇ ਰਸਤੇ ਵਿੱਚ ਅਸੀਂ ਬਹੁਤ ਮਜ਼ਾ ਕੀਤਾ ਅਤੇ ਜਿੱਥੇ ਵੀ ਸਾਨੂੰ ਵਧੀਆ ਸਪੋਟ ਲੱਭਦੀ ਸੀ ਅਸੀਂ ਉੱਥੇ ਹੀ ਰੁਕ ਜਾਂਦੇ ਜਾਂਦੇ ਜਾਂਦੇ ਅਸੀਂ ਕਈ ਪਿੰਡ ਅਤੇ ਸ਼ਹਿਰ ਪਾਰ ਕਰਨ ਤੋਂ ਬਾਅਦ ਛੋਟੀਆਂ ਪਹਾੜੀਆਂ ਚੜ੍ਹਨ ਲੱਗੇ ਜਦੋਂ ਸਾਡੀ ਗੱਡੀ ਅੱਗੇ ਵੱਧਦੀ ਮੇਰੇ ਉਤਸੁਕਤਾ ਹੋਰ ਵੱਧਦੀ ਅਤੇ ਮੈਂ ਹਰ ਨਵੀਂ ਜਰਨ ਜਗ੍ਹਾ ਦੀ ਇੱਕ ਤਸਵੀਰ ਆਪਣੇ ਕੈਮਰੇ ਵਿੱਚ ਕੈਦ ਕਰ ਲੈਂਦੀ ਰਸਤੇ ਵਿੱਚ ਹੀ ਸਾਨੂੰ ਤਾਜ਼ੇ ਪਾਣੀ ਦੇ ਝਰਨੇ ਵਿਖੇ ਜੋ ਬਹੁਤ ਹੀ ਮਨਮੋਹਕ ਸਨ ਅਤੇ ਉਹਨਾਂ ਦਾ ਪਾਣੀ ਬਹੁਤ ਹੀ ਸਵਾਦ ਸੀ ਜਿਉਂ ਜਿਉਂ ਅੱਗੇ ਜਾਂਦੇ ਪਹਾੜ ਉੱਚੇ ਤੋਂ ਹੋਰ ਉੱਚੇ ਹੁੰਦੇ ਜਾਂਦੇ ਆਖਰ ਅਸੀਂ ਬਹੁਤ ਪਹਾੜ ਪਿੰਡ ਪਾਰ ਕਰਕੇ ਇੱਕ ਸਮਤਲ ਜ਼ਮੀਨ 'ਤੇ ਪਹੁੰਚੇ ਅਤੇ ਇਹ ਸੀ ਅਸਲੀ ਕਸ਼ਮੀਰ ਸੱਚਮੁੱਚ ਹੀ ਧਰਤੀ ਦੀ ਜੰਨਤ ਮੈਂ ਹਰ ਪਹਾੜੀ ਦੀ ਤਸਵੀਰ ਕੈਦ ਕੀਤੀ ਅਤੇ ਕਈ ਬਰਫ ਨਾਲ ਲੱਦੀਆਂ ਪਹਾੜੀਆਂ ਵੀ ਆਪਣੀਆਂ ਯਾਦਾਂ ਵਿੱਚ ਸੰਜੋ ਲਈਆਂ ਫਿਰ ਅਸੀਂ ਉੱਥੋਂ ਗੁਰਦੁਆਰਾ ਸਾਹਿਬ ਵੀ ਵੇਖੇ ਉਹ ਗੁਰਦੁਆਰਾ ਸਾਹਿਬ ਦੀਆਂ ਫੋਟੋਆਂ ਮੈਂ ਸੋਸ਼ਲ ਮੀਡੀਆ 'ਤੇ ਵੀ ਪਾਈਆਂ ਜਿਸ 'ਤੇ ਮੈਨੂੰ ਬਹੁਤ ਸਾਰੇ ਵਿਊ ਅਤੇ ਲਾਇਕ ਵੀ ਆਏ ਅਸੀਂ ਗੁਲਮਰਗ ਪਹਾੜੀ 'ਤੇ ਗਏ ਜਿੱਥੇ ਤਰ੍ਹਾਂ ਤਰ੍ਹਾਂ ਦੇ ਕੁਦਰਤੀ ਫੁੱਲ ਖਿੜੇ ਹੋਏ ਸਨ ਜਿਹਨਾਂ ਦੀਆਂ ਫੋਟੋਆਂ ਮੈਂ ਆਪਣੇ ਕੈਮਰੇ ਵਿੱਚ ਕੈਦ ਕਰ ਲਈਆਂ ਅਸੀਂ ਉੱਥੇ ਡਲ ਲੇਕ 'ਤੇ ਵੀ ਪੂਰਾ ਦਿਨ ਮਨੋਰੰਜਨ ਕੀਤਾ ਅਸੀਂ ਸ਼ਿਕਾਰਾ ਘਰ ਵਿੱਚ ਰਾਤ ਕੱਟੀ ਅਤੇ ਉਹ ਯਾਦਾਂ ਵੀ ਆਪਣੇ ਕੈਮਰੇ ਵਿੱਚ ਖਿੱਚ ਲਈਆਂ ਸਾਡੇ ਸਾਰੇ ਹੀ ਟਰਿਪ ਵਿੱਚ ਅਸੀਂ ਬੜਾ ਆਨੰਦ ਲਿਆ ਬਹੁਤ ਲੋਕ ਦੂਰੋਂ ਦੂਰੋਂ ਉਹ ਪਹਾੜੀਆਂ ਦਾ ਆਨੰਦ ਲੈਣ ਲਈ ਉੱਥੇ ਪਹੁੰਚੇ ਸਨ ਚਸ਼ਮੇ ਸ਼ਾਹੀ ਵੀ ਗਏ ਉਹ ਨਜ਼ਾਰਾ ਤਾਂ ਸੱਚੀ ਅਦਭੁਤ ਸੀ ਅਤੇ ਉਸ ਦੀਆਂ ਖਿੱਚੀਆਂ ਫੋਟੋਆਂ ਮੈਨੂੰ ਅੱਜ ਵੀ ਉਹ ਸਾਰਾ ਕੁਝ ਸਾਹਮਣੇ ਲਿਆ ਕੇ ਖੜ੍ਹਾ ਕਰ ਦਿੰਦੀਆਂ ਹਨ ਵਾਪਸੀ 'ਤੇ ਬਹੁਤ ਸਾਰੀਆਂ ਥਾਵਾਂ 'ਤੇ ਪਹਾੜੀਆਂ ਡਿੱਗੀ ਪਹਾੜੀਆਂ ਡਿੱਗ ਗਈਆਂ ਜਿਸ ਕਾਰਨ ਸਾਨੂੰ ਰਸਤਾ ਬਦਲਣਾ ਪਿਆ ਅਤੇ ਉਸ ਰਸਤੇ 'ਤੇ ਹੋਰ ਵੀ ਕਈ ਨਵੇਂ ਪਿੰਡ ਵੇਖਣ ਨੂੰ ਅਤੇ ਕੈਮਰੇ ਵਿੱਚ ਕੈਦ ਕਰਨ ਨੂੰ ਮਿਲੇ ਸਨ